ਪੰਜਾਬੀ ਗਾਇਕੀ ਦਾ ਬੁਰਾ ਪੱਖ ਕੀ ਹੈ ਇਸਦਾ ਪੱਖ ਇਹ ਹੈ ਕਿ ਸਭ ਤੋਂ ਪਹਿਲਾਂ ਸਾਵਧਾਨੀਆਂ ਇਸ ਦੀਆਂ ਇਹ ਹਨ ਕਿ ਗਲਤ ਗੀਤ ਗਲਤ ਸੌਂਗ ਕੁਛ ਵੀ ਨਹੀਂ ਚਲਣਾ ਚਾਹੀਏ ਇਸ ਕਰਕੇ ਕੁਛ ਵੀ ਨਹੀਂ ਐਸਾ ਨਹੀਂ ਹੋਣਾ ਚਾਹੀਏ ਸਭ ਤੋਂ ਵਧੀਆ ਗੱਲ ਇਹ ਆ ਕਿ ਸਾਫ ਔਰ ਸੁਥਰਾ ਪੰਜਾਬੀ ਗਾਇਕੀ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਇਸ ਨੂੰ ਚੰਗਾ ਸਮਝ ਸਮਝੇ ਇਸ ਕਰਕੇ ਹਰ ਹਰ ਆਦਮੀ ਨੂੰ ਪੰਜਾਬੀ ਗਾਇਕੀ ਸੁਣਨ ਦਾ ਪੱਖ ਹੋਣਾ ਚਾਹੀਦਾ ਇਸ ਕਰਕੇ ਇਸ ਨੂੰ ਬੜੀ ਹੀ ਸਾਵਧਾਨੀ ਦੇ ਨਾਲ ਸਮਝਣਾ ਚਾਹੀਏ ਦਨਿਆਵਾਦ